ਹੈਲੋ

ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਿੰਮਤ ਗੱਲ ਕਰ ਰਿਹਾ ਅੱਛਾ ਜੀ ਠੀਕ ਹੈ ਠੀਕ ਹੈ ਹਾਂਜੀ ਮੈਂ ਹੁਸ਼ਿਆਰਪੁਰ ਤੋਂ ਬਿਲਕੁਲ ਫੈਸਟੀਵਲਸ ਅੱਛਾ ਜੀ ਹੁਸ਼ਿਆਰਪੁਰ 'ਚ ਫੈਸਟੀਵਲ ਤਾਂ ਤਕਰੀਬਨ ਸਾਰੇ ਹੀ ਮਨਾਏ ਜਾਂਦੇ ਪਰ ਸਭ ਤੋਂ ਜ਼ਿਆਦਾ ਜਿਹੜਾ ਮਸ਼ਹੂਰ ਹੁਸ਼ਿਆਰਪੁਰ ਦਾ ਦੁਸਹਿਰਾ ਹੀ ਹੈ ਤੁਸੀਂ ਸੁਣਿਆ ਵੀ ਹੋਵੇਗਾ ਕਿਤੇ ਨਾ ਹੁਸ਼ਿਆਰਪੁਰ ਦੁਸਹਿਰਾ ਤਾਂ ਕਾਫ਼ੀ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਨੇ ਹਾਂਜੀ ਹਾਂਜੀ ਕਾਫ਼ੀ ਮਤਲਬ ਕਿ ਸਿਟਿੰਗ ਸੀ ਐੱਮ ਵੀ ਆਉਂਦੇ ਰਹੇ ਹੈ ਹਰੇਕ ਵਾਰ ਬਹੁਤ ਮਸ਼ਹੂਰ ਹੈ ਬਹੁਤ ਵੱਡੇ ਲੈਵਲ 'ਤੇ ਸਾਡੀ ਕਮੇਟੀ ਬਣੀ ਪਈ ਹੈ ਜਿਹੜੇ ਕਰਦੇ ਨੇ ਯੂਨੀਕ ਹਾਂਜੀ ਹਾਂਜੀ ਬਿਲਕੁਲ ਤੁਹਾਨੂੰ ਹੋਰ ਕਿਤੇ ਨਹੀਂ ਮਿਲੂਗਾ ਇੱਥੇ ਜਿੱਦਾਂ ਦੁਪਹਿਰੇ ਤੋਂ ਪਹਿਲਾ ਨਾ ਹਨੂਮਾਨ ਜੀ ਦੀ ਬਾਣੀ ਕੱਢਦੇ ਉਨ੍ਹਾਂ ਦਾ ਸਰੂਪ ਤਿਆਰ ਕੀਤਾ ਜਾਂਦਾ ਹੈ ਅਤੇ ਉਹ ਯੰਗਸਟਰ ਨੇ ਆਪਣੇ ਯੂਥ ਨੇ ਆਪਣੀ ਸੁਸਾਇਟੀਸ ਬਣਾਈਆਂ ਹੋਈਆਂ ਨੇ ਅਲੱਗ ਅਲੱਗ ਰਜਿਸਟਰਡ ਕਲੱਬ ਨੇ ਉਹ ਹਰੇਕ ਕਲੱਬ ਆਪਣੇ ਇੱਦਾਂ ਬਾਣੀ ਤਿਆਰ ਕਰਦੇ ਨੇ ਅਤੇ ਉਹ ਬਾਣੀ ਤਿਆਰ ਕਰਕੇ ਫੇਰ ਅਲੱਗ ਅਲੱਗ ਘਰਾਂ 'ਚ ਜਾਂਦੇ ਨੇ ਲੋਕਾਂ ਦੇ ਅਤੇ ਹਾਂਜੀ ਹਾਂਜੀ ਹਾਂਜੀ ਬਿਲਕੁਲ ਇਹ ਤਿਆਰ ਵੀ ਉੱਥੋਂ ਹੀ ਕਰਵਾਉਂਦੇ ਨੇ ਕੁਰੂਕਸ਼ੇਤਰ ਦੇ ਏਰੀਏ ਤੋਂ ਹੀ ਤਿਆਰ ਕਰਵਾਉਂਦੇ ਨੇ ਅਤੇ ਨਹੀਂ ਉਹ ਬਿਲਕੁਲ ਬਹੁਤ ਚੀਜ਼ ਤੁਹਾਨੂੰ ਅਲੱਗ ਦੇਖਣ ਨੂੰ ਮਿਲੂਗੀ ਜੇ ਤੁਹਾਨੂੰ ਮੌਕਾ ਮਿਲੂਗਾ ਤਾਂ ਤੁਸੀਂ ਦੇਖੋਗੇ ਬਹੁਤ ਵਧੀਆ ਚੀਜ਼ ਹੈ ਉਹਦੇ ਨਾਲ ਇੱਕ ਪੂਰੇ ਸ਼ਹਿਰ 'ਚ ਨਾ ਇੱਕ ਧਾਰਮਿਕ ਇਕੱਠਤਾ ਦਾ ਮਾਹੌਲ ਬਣ ਜਾਂਦਾ ਹੈ ਹਾਂਜੀ ਹਾਂਜੀ ਬਿਲਕੁਲ ਸਾਡੇ ਰਿਲੀਜੀਅਸ ਐਕਟੀਵਿਟੀਜ਼ ਬਹੁਤ ਧਾਰਮਿਕ ਏਕਤਾ ਵੀ ਹੈਗੀ ਹੈ ਲੋਕਾਂ 'ਚ ਤੁਸੀਂ ਦੇਖੋਗੇ ਸਾਰੇ ਇੱਕ ਦੂਜੇ ਦੇ ਧਾਰਮਿਕ ਜੇ ਕੋਈ ਵੀ ਫੈਸਟੀਵਲ ਤਿਉਹਾਰ ਜਿਹੜਾ ਵੀ ਆਉਂਦਾ ਉਹ ਉਹਦੇ ਵਿੱਚ ਹਿੱਸਾ ਲੈਂਦੇ ਨੇ ਹੁਣ ਦੁਸਹਿਰਾ ਆਉਂਦਾ ਉਹਦੇ ਵਿੱਚ ਹਰੇਕ ਵਰਗ ਦੇ ਲੋਕ ਜਾਂਦੇ ਨੇ ਤਕਰੀਬਨ ਸਾਰਾ ਸ਼ਹਿਰ ਉੱਥੇ ਸ਼ਾਮਿਲ ਹੁੰਦਾ ਹਾਂਜੀ ਰੂਲ ਰੈਗੂਲੇਸ਼ਨ ਹਾਂਜੀ ਪੂਰਾ ਐਡਮਿਸਟ੍ਰੇਟਰ ਜਿਹੜਾ ਉੱਥੇ ਕੰਮ ਕਰਦਾ ਹੈਗਾ ਉੱਥੇ ਈਵਨ ਕਿ ਡੀ ਸੀ ਵੀ ਹੈਗੇ ਜਿਹੜੇ ਉਹ ਉਹ ਨੂੰ ਸੁਪਰਵਾਇਜ਼ ਉਹੀ ਕਰਦੇ ਨੇ ਅਤੇ ਪੁਲਸ ਪ੍ਰਸਾਸ਼ਨ ਦੀ ਸਹਾਇਤਾ ਨਾਲ ਸਾਰਾ ਮੈਨੇਜ ਕੀਤਾ ਜਾਂਦਾ ਟਰੈਫਿਕ ਸਮੱਸਿਆ ਆਉਂਦੀ ਆ ਹਾਂਜੀ ਉੱਥੇ ਲੋਕੀ ਆਉਂਦੇ ਨੇ ਬਾਹਰੋਂ ਬਹੁਤ ਦੂਰੋਂ ਦੂਰੋਂ ਲੋਕੀ ਆਉਂਦੇ ਟ੍ਰੈਫ਼ਿਕ ਤਾਂ ਆਮ ਗੱਲ ਹੈ ਫੇਰ ਹੋਣੀ ਆ ਬਿਲਕੁਲ ਬਹੁਤ ਵਧੀਆ ਦੁਸਹਿਰਾ ਹੁੰਦਾ ਹੈ ਅਤੇ ਦਸ ਦਿਨ ਜਿਹੜਾ ਹੁੰਦੇ ਨੇ ਉਹ ਦ ਦੁਪਹਿਰੇ ਤੋਂ ਪਹਿਲਾ ਨੌਂ ਦਿਨ ਜਿਹੜੇ ਹੁੰਦੇ ਹੈ ਨਵਰਾਤਰੇ ਉਹ ਬਹੁਤ ਵਧੀਆ ਹੈ ਹਾਂਜੀ ਰਾਮ ਲੀਲਾ ਕਮੇਟੀ ਹੈਗੀ ਹੈ ਉਹ ਬਿਲਕੁਲ ਤੁਹਾਨੂੰ ਰਾਮ ਲੀਲਾ ਬਣਾ ਕਰਦੇ ਨੇ ਅਤੇ ਐਨ ਵਧੀਆ ਰ ਰੀਅਲ ਲੱਗਦਾ ਤੁਹਾਨੂੰ ਵੇਖ ਕੇ ਬਈ ਅਤੇ ਸ਼ੋਭਾ ਯਾਤਰਾ ਵੀ ਕੱਢੀ ਜਾਂਦੀ ਹੈ ਰਾਮ ਵਿਵਾਹ ਵੀ ਹੁੰਦਾ ਹੈ ਹਾਂਜੀ ਹਾਂਜੀ ਹਾਂਜੀ ਹੁੰਦੀਆਂ ਨੇ ਛੁੱਟੀਆਂ ਬੱਚਿਆਂ ਨੂੰ ਇਹੀ ਮੰਥ ਹੈ ਜਿਹੜਾ ਜਿਹਦੇ ਵਿੱਚ ਜ਼ਿਆਦਾ ਛੁੱਟੀਆਂ ਵੀ ਬੱਚਿਆਂ ਨੂੰ ਹੋ ਜਾਂਦੀਆਂ ਕਾਫ਼ੀ ਪੰਜਾਬ ਸਰਕਾਰ ਹੀ ਕਰ ਦਿੰਦੀ ਸਾਡੇ ਤਾਂ ਵਧੀਆ ਬਿਲਕੁਲ ਅਤੇ ਸਾਰੀਆਂ ਪਾਰਟੀਆਂ ਰਲ ਕੇ ਮਨਾਉਂਦੀਆਂ ਨੇ ਠੀਕ ਹੈ ਓਕੇ ਜੀ ਥੈਂਕ ਯੂ ਠੀਕ ਹੈ